ਛੇ ਜੂਨ ਉੱਨੀ ਸੌ ਅਠਾਸੀ ਦੋ ਫਰਵਰੀ ਦੋ ਹਜ਼ਾਰ ਤਿੰਨ ਮਾਰਚ ਉੱਨੀ ਸੌ ਪਚਾਨਵੇਂ ਸੱਤ ਜੁਲਾਈ ਉੱਨੀ ਸੌ ਸੱਠ ਦਸ ਦਸੰਬਰ ਦੋ ਹਜ਼ਾਰ ਚੌਵੀ